ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕਦੋਂ ਤੱਕ ਚਾਹੀਦਾ ਤੁਹਾਨੂੰ ਓਕੇ ਤੁਸੀਂ ਕਿਆ ਕਹਿੰਦੇ ਉਹਨੂੰ ਤਾਂ ਤੁਸੀਂ ਕਦੋਂ ਸਵਾਣਾ ਕਿਵੇਂ ਦਾ ਸੂਟ ਪੂਰਾ ਪੰਜਾਬੀ ਸੂਟ ਹੀ ਸਵਾਣਾ ਸਿੰਪਲ ਪਰ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗ ਜੂਗਾ ਤੁਹਾਨੂੰ ਕਿੰਨੀ ਦੇਰ ਤੱਕ ਚਾਹੀਦਾ ਤੁਸੀਂ ਇਹ ਦੱਸ ਸਕਦੇ ਹੈ ਦਸ ਕੁ ਦਿਨ ਤੱਕ ਵੈਸੇ ਤਾਂ ਮੇਰੇ ਕੋਲ ਬਹੁਤ ਸਾਰੇ ਹੋਰ ਵੀ ਸੂਟ ਆਏ ਹੋਏ ਹੈ ਔਖਾ ਹੈ ਪਰ ਮੈਂ ਦੇਖ ਲੂੰਗੀ ਕੋਈ ਨਾ ਮੈਂ ਦੇਖ ਲਵਾਂਗੀ ਅਤੇ ਤੁਸੀਂ ਨਾਪ ਵਗੈਰਾ ਦਾ ਕਿਵੇਂ ਕਰੋਂਗੇ ਠੀਕ ਹੈ ਜੀ ਅਤੇ ਤੁਸੀਂ ਮੈਨੂੰ ਆਪਣਾ ਨਾਪ ਦੱਸ ਦਿਓ ਅਤੇ ਜਦੋਂ ਵੀ ਤੁਸੀਂ ਆਣ ਆ ਕੇ ਦੇਖਣਾ ਹੋਇਆ ਨਾ ਤੁਸੀਂ ਦੇਖ ਸਕਦੇ ਹੋ ਅਤੇ ਮੈਨੂੰ ਵੀ ਵਗੈਰਾ ਹੋਰ ਵੀ ਇਨਫੋਰਮੇਸ਼ਨ ਦੇ ਦੋ ਕਿ ਤੁਹਾਨੂੰ ਕਿਵੇਂ ਦਾ ਚਾਹੀਦਾ ਕਦੋਂ ਚਾਹੀਦਾ ਜਾਂ ਹੋਰ ਹਾਂਜੀ ਓਕੇ

ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਤੁਸੀਂ ਹੋਰ ਵੀ ਦੱਸ ਦੋ ਕਿ ਤੁਹਾਨੂੰ ਹੋਰ ਸੂਟ ਵਿੱਚ ਕੀ ਕੀ ਉਹ ਚਾਹੀਦਾ ਹੈ ਠੀਕ ਹੈ ਜੀ ਤੁਸੀਂ ਫਿਰ ਸਾਡੇ ਇੱਕ ਵਾਰ ਆ ਕੇ ਬੁਟੀਕ ਪਰ ਫਿਰ ਸਾਨੂੰ ਦੱਸ ਦਿਓ ਅਸੀਂ ਤੁਹਾਡਾ ਕਰ ਦੂੰਗੇ ਹਾਂਜੀ ਠੀਕ ਹੈ ਓਕੇ ਥੈਂਕ ਯੂ